ਸਾਡੇ ਭਾਰਤ ਵਿੱਚ ਕਲਾ ਸ਼ੈਲੀਆਂ ਬਹੁਤ ਹਨ ਜਿਵੇਂ ਕਿ ਚਿੱਤਰ ਕਲਾ ਹੋ ਗਈ ਮੂਰਤੀ ਕਲਾ ਹੋ ਗਈ ਨ੍ਰਿੱਤਿਆ ਕਲਾ ਹੋ ਗਈ ਨ੍ਰਿੱਤਿਆ ਕਲਾ ਵਿੱਚ ਵੀ ਕਾਫੀ ਤਰ੍ਹਾਂ ਦੇ ਨ੍ਰਿੱਤਿਆ ਹੁੰਦੇ ਨੇ ਜਿਵੇਂ ਕਿ ਪੰਜਾਬੀਆਂ ਵਿੱਚ ਭੰਗੜੇ ਦੀ ਕਲਾ ਭੰਗੜਾ ਕਰਦੇ ਨੇ ਹਿੰ ਹਰਿਆਣੇ ਵਿੱਚ ਜਾਂਦੇ ਹਾਂ ਅਤੇ ਹਰਿਆਣਵੀ ਡਾਂਸ ਮਿਲਦਾ ਹੈ ਸੰਸਕ੍ਰਿਤੀ ਡਾਂਸ ਮਿਲਦਾ ਅਲੱਗ ਅਲੱਗ ਤਰ੍ਹਾ ਦੇ ਕਾਫੀ ਵੈਸਟਰਨ ਡਰੈੱਸ ਪਾ ਕੇ ਵੈਸਟਰਨ ਡਰੈੱਸ ਦਾ ਡਾਂਸ ਆ ਜਾਂਦਾ ਜਿਵੇਂ ਕਿ ਉਹਨੂੰ ਸਾਲਸਾ ਡਾਂਸ ਬੋਲ ਦਿੰਦੇ ਨੇ ਕੋਈ ਕਿਵੇਂ ਬੋਲਦੇ ਸਾਡੇ ਕੋਲ ਮਤਲਬ ਕਲਾ ਸ਼ੈਲੀਆਂ ਬਹੁਤ ਨੇ ਹਰ ਤਰ੍ਹਾਂ ਦੀ ਕਲਾ ਸ਼ੈਲੀ ਵਿੱਚ ਅਸੀਂ ਅੱਗੇ ਰਹੇ ਹਾਂ ਅਸੀਂ ਦੂਸਰੇ ਦੇਸ਼ਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਸਾਡੇ ਕੋਲ ਹਰ ਤਰ੍ਹਾਂ ਦੀ ਕਲਾ ਦਾ ਹਰ ਤਰ੍ਹਾਂ ਦੀ ਕਲਾ ਦਾ ਮਹੱਤਵ ਵੀ ਹੁੰਦਾ ਇਹ ਨਹੀਂ ਹੈ ਕਿ ਅਸੀਂ ਇਕੱਲੀ ਕਲਾ ਹੀ ਦੀ ਦਰਸਉਂਦੇ ਹਾਂ ਕਲਾ ਦੇ ਨਾਲ ਸਾਡੇ ਕੋਲ ਇੱਕ ਮੋਟੀਵੇਸ਼ਨ ਵੀ ਹੁੰਦਾ ਜਿਹੜਾ ਕਿ ਅਸੀਂ ਦਿਖਾ ਸਕਦੇ ਹਾਂ ਮੂਰਤੀ ਕਲਾ ਮੂਰਤੀਆਂ ਬਣਾ ਕੇ ਅਸੀਂ ਤਿਓਹਾਰਾਂ ਦੇ ਟਾਈਮ 'ਤੇ ਦੇਵੀ ਦੇਵਤਿਆਂ ਦਾ ਰੂਪ ਦੇ ਕੇ ਮੂਰਤੀਆਂ ਨੂੰ ਉਹ ਅਸੀਂ ਮੂਰਤੀ ਕਲਾ ਦੀ ਵੀ ਰਿਸਪੈਕਟ ਕਰਦੇ ਹਾਂ ਉਹਨਾਂ ਨੂੰ ਮੂਰਤੀਆਂ ਬਣਾ ਕੇ ਉਹਨਾਂ ਵਿੱਚ ਕਲਰ ਕਰਕੇ ਰੰਗ ਭਰ ਕੇ ਉਹਨਾਂ ਨੂੰ ਰੰਗ ਬਿਰੰਗੀਆਂ ਬਣਾ ਕੇ ਅਸੀਂ ਦਿਖਾ ਸਕਦੇ ਹਾਂ ਅਸੀਂ ਦੀਵਾਲੀ ਦੇ ਟਾਈਮ 'ਤੇ ਦੀਵੇ ਬਣਾ ਲੈਂਦੇ ਹਾਂ ਮੂਰਤੀ ਕਲਾ ਦਾ ਹੀ ਵਿੱਚ ਵੀ ਕਾਫੀ ਤਰ੍ਹਾਂ ਦੇ ਮਿੱਟੀ ਦੇ ਅਸੀਂ ਬਰਤਨ ਬਣਾਉਂਦੇ ਹਾਂ ਹਰ ਤਰ੍ਹਾਂ ਦੀ ਕਲਾ ਹੁੰਦੀ ਹੈ ਕਿ ਜੋ ਸਾਡੇ ਘਰ ਵਿੱਚ ਚਲਦੀ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਗੈਂਸ ਬਣੇ ਹੋਏ ਨੇ ਲੇਕਿਨ ਅਸੀਂ ਪਹਿਲਾਂ ਦੇ ਲੋਕ ਸੀ ਜਿਹੜੇ ਉਹ ਮਿੱਟੀ ਦੇ ਚੁੱਲ੍ਹੇ ਬਣਾ ਕੇ ਉਹ ਵੀ ਇੱਕ ਕਲਾ ਸੀ ਕਿ ਮਿੱਟੀ ਦੇ ਚੁੱਲ੍ਹੇ ਬਣਾ ਕੇ ਉਹਨਾਂ ਵਿੱਚ ਅਗਨੀ ਅੱਗ ਨੂੰ ਬਾਲ ਕੇ ਵਧੀਆ ਫਿਰ ਖਾਣਾ ਬਣਾਉਂਦੇ ਸੀ ਜਿਹੜੇ ਖਾਣੇ ਦਾ ਸਵਾਦ ਹੀ ਅਲੱਗ ਹੁੰਦਾ ਸੀ ਸਾਡੀ ਮਤਲਬ ਭਾਰਤ ਵਿੱਚ ਬਹੁਤ ਕਲਾ ਨੇ ਹਰ ਤਰ੍ਹਾਂ ਦੀ ਹਰ ਕਲਾ ਦੀ ਅਲੱਗ ਅਲੱਗ ਮਹਿਤਵਤਾ ਰਹੀ ਹੈ